ਪੰਜਾਬੀ ਭਾਸ਼ਾ ਇੱਕ ਇਸ ਤਰ੍ਹਾਂ ਦੀ ਭਾਸ਼ਾ ਹੈ ਕਿ ਜਿਸ ਨੂੰ ਬੋਲਣ ਵਾਸਤੇ ਸਾਨੂੰ ਆਪਣੇ ਅੰਦਰੋਂ ਬਹੁਤ ਜ਼ਿਆਦਾ ਜਾਨ ਲਾਉਣੀ ਪੈਂਦੀ ਹੈ ਪਰ ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਵੀ ਇਸ ਤਰ੍ਹਾਂ ਹਨ ਜਿਸ ਨੂੰ ਬਾਕੀ ਇੰਡੀਆ ਦੀ ਬਾਕੀ ਸਟੇਟਾਂ ਵਿੱਚ ਲੱਗਦਾ ਹੈ ਕਿ ਬਹੁਤ ਹੀ ਜ਼ਿਆਦਾ ਬੁਰੀ ਭਾਸ਼ਾ ਹਨ ਨਾ ਪਰ ਨਾ ਕਿ ਇਕੱਲੇ ਭਾਰਤ ਵਿੱਚ ਬਲਕਿ ਬਾਹਰ ਦੇ ਕੰਨ ਦੇਸ਼ਾਂ ਵਿੱਚ ਵੀ ਇੱਦਾਂ ਲੋਕ ਸਮਝਦੇ ਹਨ ਕਿ ਆ ਬਹੁਤ ਹੀ ਜ਼ਿਆਦਾ ਪੁਰੀ ਬੁਰੀ ਭਾਸ਼ਾ ਹਨ ਇਸ ਦਾ ਕਾਰਨ ਵੀ ਹਨ ਕਿਉਂਕਿ ਪੰਜਾਬੀ ਭਾਸ਼ਾ ਵਿੱਚ ਬਹੁਤ ਜ਼ਿਆਦਾ ਸ਼ਬਦ ਇੱਦਾਂ ਦੇ ਹਨ ਜਿਹੜੇ ਦੂਜੀ ਭਾਸ਼ਾ ਵਿੱਚ ਗਲਤ ਮੰਨੇ ਜਾਂਦੇ ਹਨ ਪਰ ਇਸ ਦੇ ਇਹਦਾ ਆਹ ਮਤਲਬ ਨਹੀਂ ਹੈ ਕਿ ਆ ਭੈੜੀ ਭਾਸ਼ਾ ਹਨ ਕਿਉਂਕਿ ਪੰਜਾਬੀ ਸ਼ੁਰੂ ਤੋਂ ਹੀ ਇੱਦਾਂ ਹੀ ਚਲਦੀ ਆ ਰਹੀ ਹਨ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਹ ਭਾਸ਼ਾ ਵੀ ਚੰਗੀ ਭਾਸ਼ਾ ਹਨ ਆਹ ਭਾਸ਼ਾ ਇੱਕ ਇੱਦਾਂ ਦੀ ਭਾਸ਼ਾ ਹੈ ਜਿਹੜੇ ਬੜੇ ਸਾਲਾਂ ਪਹਿਲਾਂ ਦੀ ਚਲੀ ਆ ਰਹੀ ਹਨ ਆਹ ਭਾਸ਼ਾ ਵਿੱਚ ਲੋਕ ਆਪਣੇ ਦਿਲੋਂ ਗੱਲਾਂ ਕਰਦੇ ਹਨ ਅਤੇ ਜੇ ਹਰ ਇੱਕ ਸ਼ਬਦ ਦਾ ਬਹੁਤ ਹੀ ਜ਼ਿਆਦਾ ਗਹਿਰਾ ਸੰਬੰਧ ਹੁੰਦਾ ਹੈਨ ਇਹ ਆਪਣੀ ਹਿਸਟਰੀ ਨਾਲ ਅਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਹ ਭਾਸ਼ਾ ਵੀ ਇੱਕ ਚੰਗੀ ਭਾਸ਼ਾ ਹਨ ਇਸ ਨ ਨੂੰ ਅ ਚੰਗਾ ਬਣਾਉਣ ਵਾਸਤੇ ਲੋਕ ਇੱਦਾਂ ਵੀ ਕਰ ਸਕਦੇ ਹਨ ਕਿ ਇਹ ਇਸ 'ਤੇ ਨਵੀਂ ਨਵੀਂ ਕਲਾਸਾਂ ਲਾ ਸਕਦੇ ਹਨ ਔਨਲਾਈਨ ਯੂਟੀਊਬ 'ਤੇ ਜਾਂ ਫਿਰ ਹਰ ਇੱਕ ਸਟੇਟ ਵਿੱਚ ਤਾਂ ਕਿ ਲੋਕ ਉੱਥੇ ਜਾ ਕੇ ਸਮਝ ਸਕੇ ਆਹ ਭਾਸ਼ਾ ਨੂੰ ਸਿੱਖ ਸਕੇ ਅਤੇ ਸਮਝ ਸਕੇ ਕਿ ਆਹ ਭਾਸ਼ਾ ਇੱਕ ਚੰਗੀ ਭਾਸ਼ਾ ਹਨ ਭਾਸ਼ਾ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਅਤੇ ਆਹ ਭਾਸ਼ਾ ਦਾ ਭਵਿੱਖ ਕਾਫੀ ਚੰਗਾ ਵੱਡਾ ਹਨ ਲੋਕਾਂ ਨੂੰ ਸਮਝਣਾ ਚਾਹੀਦਾ ਹਨ ਕਿ ਆਹ ਭਾਸ਼ਾ ਵੀ ਭਾਰਤ ਦਾ ਇੱਕ ਹਿੱਸਾ ਹਨ ਭਾਰਤ ਦੀ ਆਜ਼ਾਦੀ ਦੇ ਵਿੱਚ ਵੀ ਆਹ ਭਾਸ਼ਾ ਦੇ ਲੋਕਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਹਨ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਹ ਭਾਸ਼ਾ ਦੇ ਲੋਕ ਵੀ ਸਾਡੇ ਦੇਸ਼ ਦੇ ਲੋਕ ਹਨ ਪੰਜਾਬੀ ਭਾਸ਼ਾ ਨਾ ਕਿ ਇਕੱਲੀ ਇਹ ਭਾਰਤ ਦੀ ਭਾਸ਼ਾ ਹਨ ਬਲਕਿ ਆਹ ਹੌਲੀ ਹੌਲੀ ਬਾਹਰ ਦੀਆਂ ਕੰਟਰੀਆਂ ਵਿੱਚ ਵੀ ਫੈਲੀ ਜਾ ਰਹੀ ਹਨ ਕਿਉਂਕਿ ਇਸ ਦੇ ਲੋਕ ਬਾਹਰ ਜਾ ਕੇ ਸੈਟਲ ਹੁੰਦੇ ਹਨ ਅਤੇ ਲੋਕ ਬਾਕੀ ਦੇਸ਼ ਦੇ ਲੋਕਾਂ ਨੂੰ ਵੀ ਦੱਸਦੇ ਹਨ ਕਿ ਪੰਜਾਬੀ ਭਾਸ਼ਾ ਦੇ ਲੋਕੀ ਚੰਗੇ ਵੀ ਹੋ ਸਕਦੇ ਹਨ ਪੰਜਾਬੀ ਭਾਸ਼ਾ ਨੂੰ ਸਿਰਫ਼ ਚੰਗਾ ਹੀ ਨਾ ਸਮਝੋ ਬਲਕਿ ਇਹਨੂੰ ਸਿੱਖੋ ਵੀ ਤਾਂ ਕਿ ਆਹ ਭਾਸ਼ਾ ਦਾ ਅੱਗੇ ਭਵਿੱਖ ਹੋਰ ਵਧੀਆ ਬਣ ਸਕੇ